ਸਾਡੇ ਭਾਰਤ ਵਿੱਚ ਬਹੁਤ ਹੀ ਤਰ੍ਹਾਂ ਦੇ ਡਾਂਸ ਅਤੇ ਭੰਗੜੇ ਗਿੱਧੇ ਹਨ ਭੰਗੜਾ ਆ ਗਾਇਕ ਸਭ ਸਭ ਕਰਦੇ ਹਨ ਕਿਉਂਕਿ ਸਾਡੇ ਭਾਰਤ ਵਿੱਚ ਬਹੁਤ ਤਰ੍ਹਾਂ ਦੇ ਭੰਗੜੇ ਡਾਂਸ ਹਨ ਇਸ ਕਰਕੇ ਸਾਨੂੰ ਐ ਵਧੀਆ ਲੱਗਦਾ ਹੈ